ਭਾਰਤ ਵਿੱਚ ਬਹੁਤ ਤਰ੍ਹਾਂ ਦੇ ਧਾਰਮਿਕ ਸਥਾਨ ਹਨ ਪਰ ਜਿਨ੍ਹਾਂ ਵਿੱਚ ਜ਼ਿਆਦਾਤਰ ਲੋਕ ਜਾਂਦੇ ਹਨ ਉਹ ਹਨ ਸ਼੍ਰੀ ਦਰਬਾਰ ਸਾਹਿਬ ਜੋ ਕਿ ਅੰਮ੍ਰਿਤਸਰ ਵਿੱਚ ਹੈ ਸ਼ਹੀਦਾਂ ਸਾਹਿਬ ਉਹ ਵੀ ਅੰਮ੍ਰਿਤਸਰ ਵਿੱਚ ਹੈ ਅਤੇ ਲਾਲ ਮੰਦਰ ਦੇਵੀ ਜਿਹਨੂੰ ਕਿ ਛੋਟੀ ਨੈਣਾ ਦੇਵੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਉਹ ਵੀ ਅੰਮ੍ਰਿਤਸਰ ਵਿੱਚ ਹੀ ਪੈਂਦਾ ਹੈ ਅਤੇ ਅਗਰ ਇਹ ਛੇ ਸਿੱਖਾਂ ਦਾ ਦੂਜਾ ਗੁਰਦੁਆਰਾ ਬੰਗਲਾ ਸਾਹਿਬ ਸ਼ੀਸ ਗੰਜ ਸਾਹਿਬ ਉਹ ਵੀ ਦਿੱਲੀ ਵਿੱਚ ਹੀ ਪੈਂਦੇ ਹਨ ਅਤੇ ਮੁਸਲਿਮ ਧਰਮ ਦੀ ਅਗਰ ਗੱਲ ਕਰੀਏ ਤਾਂ ਜਾਮਾ ਮਸਜਿਦ ਜੋ ਹੈ ਹਿੰਦੂਆਂ ਦੀ ਬਹੁਤ ਫੇਮਸ ਮਸਜਿਦ ਹੈ ਉਹ ਵੀ ਦਿੱਲੀ ਵਿੱਚ ਹੀ ਪੈਂਦੀ ਹੈ ਅਗਰ ਅਸੀਂ ਇਹਨਾਂ ਵਿੱਚ ਵਿਸਥਾਰ ਗੋਲਡਨ ਟੈਂਪਲ ਜਿਸਨੂੰ ਕਿ ਦਰਬਾਰ ਸਾਹਿਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਉਹਦੇ ਬਾਰੇ ਗੱਲ ਕਰੀਏ ਤਾਂ ਇਸ ਨੂੰ ਗੁਰੂ ਰਾਮਦਾਸ ਜੀ ਨੇ ਵਸਾਇਆ ਸੀਗਾ ਅਤੇ ਇਸਦੀ ਨੀਂਹ ਸੂਫ਼ੀ ਫਕੀਰ ਸਾਈਂ ਮੀਆਂ ਮੀਰ ਦੁਬਾਰਾ ਪੰਦਰਾਂ ਸੌ ਅਠਾਸੀ ਈਸਵੀ ਵਿੱਚ ਰੱਖੀ ਗਈ ਸੀ ਅਤੇ ਇੱਥੇ ਇਸਦੇ ਚਾਰੇ ਆਲੇ ਦੁਆਲੇ ਇੱਕ ਪਵਿੱਤਰ ਸਰੋਵਰ ਹੈ ਜਿੱਥੇ ਲੋਕਾਂ ਦੀ ਆਸਥਾ ਹੈਗੀ ਆ ਕਿ ਇਸ਼ਨਾਨ ਕਰਨ ਨਾਲ ਉਹਨਾਂ ਦੇ ਦੁੱਖ ਦਰਦ ਸਾਰੇ ਠੀਕ ਹੋ ਜਾਂਦੇ ਹਨ ਅਤੇ ਪੰਜਾਬ ਦੇ ਅੰਮ੍ਰਿਤਸਰ ਦੇ ਇੱਕ ਹੋਰ ਗੁਰਦੁਆਰਾ ਸ਼ਹੀਦਾਂ ਸਾਹਿਬ ਸ਼ਹੀਦਾਂ ਸਾਹਿਬ ਵਿੱਚ ਦੂਰੋਂ ਦੂਰੋਂ ਲੋਕ ਸੰਡੇ ਦੇ ਦਿਨ ਐਤਵਾਰ ਵਾਲੇ ਦਿਨ ਚੁਪੈਰਾ ਸਾਹਿਬ ਕੱਟਣ ਆਉਂਦੇ ਹਨ ਉਹਨਾਂ ਦਾ ਮੰਨਣਾ ਹੈ ਕਿ ਚੁਪੈਰਾ ਸਾਹਿਬ ਕੱਟਣ ਨਾਲ ਉਹਨਾਂ ਦੇ ਦੁੱਖ ਤਕਲੀਫ਼ ਸਾਰੇ ਦੂਰ ਹੋ ਜਾਂਦੇ ਹਨ ਅਗਰ ਦੂਜੇ ਪਾਸੇ ਅਸੀਂ ਗੱਲ ਕਰੀਏ ਸ਼ੀਸ਼ ਗੰਜ ਸਾਹਿਬ ਗੁਰਦੁਆਰਾ ਜੀ ਜੀ ਉੱਥੋਂ ਦੇ ਸ਼ੀਸ਼ ਗੰਜ ਸਾਹਿਬ ਗੁਰਦੁਆਰਾ ਗੁਰੂ ਤੇਗ ਬਹਾਦਰ ਜੀ ਨੇ ਵਸਾਇਆ ਸੀ ਉਹਨਾਂ ਦੀ ਯਾਦ ਵਿੱਚ ਉੱਥੇ ਬਣਵਾਇਆ ਗਿਆ ਸੀਗਾ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਸੀਗੇ ਅਤੇ ਅਗਰ ਅਸੀਂ ਮੁਸਲਿਮ ਧਰਮ ਦੇ ਜਾਮਾ ਮਸਜਿਦ ਜੋ ਕਿ ਦਿੱਲੀ ਵਿੱਚ ਹੈ ਉਸ ਦੇ ਬਾਰੇ ਗੱਲ ਕਰੀਏ ਤਾਂ ਜਾਮਾ ਮਸਜਿਦ ਦੇ ਵਿੱਚ ਮੁਸਲਿਮ ਧਰਮ ਜ਼ਿਆਦਾਤਰ ਈਦ ਈਦ ਦੇ ਤਿਉਹਾਰ ਨੂੰ ਮਨਾਉਣ ਲਈ ਇਕੱਠੇ ਹੁੰਦੇ ਹਨ ਈਦ ਦੇ ਤਿਉਹਾਰ ਦੇ ਦਿਨ ਅਗਰ ਸਾਰੇ ਮੁਸਲਿਮ ਲੋਕ ਸਮਾਜ ਦੇ ਲੋਕ ਉੱਥੇ ਜਾਂ ਉਹ ਮਸਜਿਦ ਜਾ ਕੇ ਆਪਣੀ ਨਮਾਜ਼ ਅਦਾ ਕਰਦੇ ਹਨ